ਫਾਜਿਲਕਾ ਸ਼ੇਤਰ ਵਿੱਚ ਇਹੋ ਜਿਹੀ ਕਈ ਸਮਾਜ ਸੇਵਿਕ ਸੰਸਥਾਵਾਂ ਨੇ ਜਿਹੜੇ ਕਿ ਖੂਨਦਾਨ ਕੈਂਪ ਤੇ ਹੋਰ ਕਈ ਸਮਾਜ ਸੇਵਿਕ ਸੰਸਥਾਵਾਂ ਕੰਮ ਕਰ ਰਹੀਆਂ ਨੇ ਜਿਨਾਂ ਵਿੱਚ ਇਕ ਜਿਵੇਂ ਕਿ ਗੀਤਾ ਭਵਨ ਗਰੀਬ ਲੋਕਾਂ ਵਾਸਤੇ ਕੰਮ ਕਰ ਰਿਹਾ ਕਿ ਵਿਧਵਾਵਾਂ ਜਾਂ ਗਰੀਬ ਲੋਕਾਂ ਵਾਸਤੇ ਰਾਸ਼ਨ ਪਾਣੀ ਦਾ ਪ੍ਰਬੰਧ ਕਰਦੇ ਨੇ ਤੇ ਗਰੀਬ ਲੋਕ ਜਿਵੇਂ ਲੰਗਰ ਵਗੈਰਾ ਦੀ ਵੀ ਕਾਫੀ ਵਿਵਸਥਾ ਕਰਵਾਈ ਜਾਂਦੀ ਏ